ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕਿਵੇਂ ਹੋ ਜੀ ਓਕੇ ਸਰ ਕੋਵਿਡ ਦੇ ਸਬੰਧ ਵਿੱਚ ਆਪਾਂ ਜਾਣਕਾਰੀ ਲੈਣੀ ਸੀਗੀ ਵਈ ਕੋਵਿਡ ਦਾ ਜਿਹੜਾ ਐਜੂਕੇਸ਼ਨ ਸੈਕਟਰ ਦੇ ਉੱਪਰ ਕਿਸ ਤਰ੍ਹਾਂ ਨਾਲ ਪ੍ਰਭਾਵ ਪਿਆ ਇਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਸੀਗੀ ਤੁਹਾਡੇ ਨਾਲ ਤਿੰਨ ਤੋਂ ਚਾਰ ਮਿੰਟ ਆਪਾਂ ਵੀ ਵਿਲ ਟੋਕ ਅਬਾਊਟ ਬੋਥ ਦ ਫੈਕਟਰਜ ਵੈਦਰ ਇਟ ਇਜ ਨੈਗਟਿਵ ਵੈਦਰ ਇਟ ਇਜ ਪੋਜਟਿਵ ਨੋ ਮੈਟਰ ਐਂਡ ਵੀ ਸ਼ੁੱਡ ਡਿਸ ਯੈਸ ਯੈਸ ਪਲੀਸ ਕੀਪ ਇਟ ਅਪ ਓਕੇ ਓਕੇ ਓਕੇ ਹੋਰ ਪੋਜਟਿਵ ਅਫੈਕਟ ਕਿਆ ਹੈ ਹੋਰ ਪੋਜਟਿਵ ਅਫੈਕਟ

ਓਕੇ ਜੀ ਅੱਛਾ ਆਪਾਂ ਇਹ ਗੱਲ ਕਹਿ ਸਕਦੇ ਵਈ ਕਰੋਨਾ ਦੀਆਂ ਨੀਤੀਆਂ ਵਿੱਚ ਹੋਈ ਜਿਹੜੀ ਐਜੂਕੇਸ਼ਨ ਪੋਲਸੀ ਪ੍ਰਭਾਵਿਤ ਹੋਈ ਜਾਂ ਐਜੂਕੇਸ਼ਨ ਪੋਲਸੀ ਨੂੰ ਅਫੈਕਟ ਮਿਲਿਆ ਕਰੋਨਾ ਪੀਰੀਅਡ ਦਾ ਔਨਲਾਈਨ ਐਜੂਕੇਸ਼ਨ ਨੂੰ ਵਧਾਵਾ ਮਿਲਿਆ ਇਹਦੇ ਅਧਾਰ 'ਤੇ ਆਪਾਂ ਕਹਿ ਸਕਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗੌਮਿੰਟ ਨੂੰ ਇਹੋ ਜਿਹੀਆਂ ਪੋਲਸੀਆਂ ਲੈ ਕੇ ਆਉਣੀਆ ਚਾਹੀਦੀਆਂ ਜਿਹਦੇ ਨਾਲ ਇਸ ਦੇਸ਼ ਦੇ ਵਿੱਚ ਔਨਲਾਈਨ ਐਜੂਕੇਸ਼ਨ ਨੂੰ ਵਧਾਵਾ ਦਿੱਤਾ ਜਾ ਸਕੇ ਤਾਂ ਕੇ ਐਜੂਕੇਸ਼ਨ ਨੂੰ ਕਿਆ ਕੀਤਾ ਜਾ ਸਕਦਾ ਅਫੋਰਡੇਵਲ ਬਣਾਇਆ ਜਾ ਸਕਦਾ ਹਰੇਕ ਦੇ ਵਾਸਤੇ ਲੀਸਟ ਲੀਸਟ ਅਡਵਾਂਟੇਜ ਦੀ ਆਪਾਂ ਗੱਲ ਕਰਦੇ ਆਪਾਂ ਅੰਤਿਮ ਯੋਜਨਾ ਦੀ ਗੱਲ ਕਰਦੇ ਵਈ ਇੱਕ ਅੰਤਿਮ ਪਾਏਦਾਨ 'ਤੇ ਜਿਹੜਾ ਖੜ੍ਹਾ ਵਿਅਕਤੀ ਹੈ ਉਹਨੂੰ ਵੀ ਸਿੱਖਿਆ ਦਾ ਜਿਹੜਾ ਲਾਭ ਮਿਲਣਾ ਚਾਹੀਦਾ ਇਹਦੇ ਬਾਰੇ ਕਿਆ ਕਹਿਣਾ ਚਾਹੋਗੇ ਓਕੇ ਓਕੇ ਓਕੇ ਓਕੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਆਪਾਂ ਤੁਹਾਡੀ ਜਿਹੜੀ ਕੌਲ ਆ ਰਿਕੋਰਡ ਕੀਤੀ ਹੈ ਆਪਣੇ ਰੈਫਰੈਂਸ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਜਾਣਕਾਰੀ ਪ੍ਰੋਵਾਈਡ ਕਰਨ ਵਾਸਤੇ ਥੈਂਕ ਯੂ ਸਰ ਓਕੇ